ਰੰਗੋਲੀ ਇੱਕ ਬਹੁਤ ਸ਼ੁਭ ਤਿਉਹਾਰ ਮੰਨਿਆਂ ਜਾਂਦਾ ਹੈ ਜਿਸ ਤਰ੍ਹਾ ਕੋਈ ਵੀ ਤਿੱਥ ਤਿਉਹਾਰ ਹੋਵੇ ਤਾਂ ਰੰਗੋਲੀ ਆਪਣੇ ਗੇਟ ਦੇ ਉੱਤੇ ਸਜਾਈ ਜਾਂਦੀ ਹੈ ਜਿਵੇਂ ਕਿ ਦੀਪਾਵਲੀ ਤਿਉਹਾਰ ਦੇ ਉੱਤੇ ਬਾਕੀ ਜੋ ਤਿਉਹਾਰ ਹਨ ਜਿਸ ਤਰ੍ਹਾਂ ਕਿ ਸੂਰਜ ਨੂੰ ਪਾਣੀ ਚੜ੍ਹਾਉਣਾ ਮੱਥੇ 'ਤੇ ਸੰਧੂਰ ਪਵਿੱਤਰ ਧਾਗਾ ਪਾਉਣਾ ਪੂਜਾ ਲਈ ਮੰਦਰ ਜਾਣਾ ਦਰਗਾਹ 'ਤੇ ਜਾਣਾ ਵਰਤ ਜਾਂ ਰੋਜਾ ਰੱਖਣਾ ਇਹ ਸਾਰੇ ਹਿੰਦੂ ਧਰਮ ਦੇ ਧਰਮ ਹਨ ਰੀਤਾਂ ਹਨ ਲੇਕਿਨ ਇਹ ਸਿੱਖ ਧਰਮ ਦੇ ਵਿੱਚ ਲਾਇਕ ਨਹੀਂ ਹਨ ਸਾਡੇ ਗੁਰੂਆਂ ਨੇ ਇਹਨਾਂ ਧਰਮਾ ਤੋਂ ਇਨ੍ਹਾਂ ਧਾਰਮਿਕ ਰੀਤਾਂ ਤੋਂ ਬਾਹਰ ਰੱਖਿਆ ਹੈ ਅਤੇ ਇਸ ਲਈ ਮਹੱਤਵ ਕਈ ਪ੍ਰਕਾਰ ਦੇ ਹਨ ਜੋ ਕਿ ਇਸ ਤਰ੍ਹਾਂ ਹਨ ਤੁਹਾਡਾ ਸੱਭਿਆਚਾਰ ਵਿੱਚ ਮਹੱਤਵ ਹੈ